ਕੀ ਤੁਸੀਂ ਜਨਤਾ ਟੈਕਸੀ ਘਰ ਤੋਂ ਬੋਲ ਰਹੇ ਹੋ ਕੱਲ੍ਹ ਮੈਂ ਤੁਹਾਡੇ ਇੱਥੇ ਬੁਕਿੰਗ ਕੀਤੀ ਸੀ ਮਾਨਸਾ ਤੋਂ ਅੰਮ੍ਰਿਤਸਰ ਜਾਣ ਲਈ ਪਰ ਕਿਸੇ ਕਾਰਨ ਵਰਸ਼ ਮੈਨੂੰ ਅੱਜ ਬਠਿੰਡਾ ਆਉਣਾ ਪਿਆ ਮੇਰੇ ਕਿਸੇ ਕਰੀਬੀ ਰਿਸ਼ਤੇਦਾਰ ਦੀ ਤਬੀਅਤ ਇੱਕੋ ਦਮ ਖਰਾਬ ਹੋ ਗਈ ਅਤੇ ਉਹ ਮੈਨੂੰ ਮਿਲਣ ਦੀ ਬੜੀ ਜ਼ਿੱਦ ਕਰ ਰਹੀ ਸੀ ਇਸ ਲਈ ਮੈਨੂੰ ਬਠਿੰਡਾ ਆਉਣਾ ਪਿਆ ਮੈਂ ਚਾਹੁੰਦੀ ਹਾਂ ਤੁਸੀਂ ਮੈਨੂੰ ਬਠਿੰਡੇ ਤੋਂ ਪਿੱਕ ਕਰੋ ਨਾ ਕਿ ਮਾਨਸਾ ਤੋਂ ਤਾਂ ਉਹ ਥੋੜ੍ਹੀ ਜਿਹੜੀ ਡਾਇਰੈਕਸ਼ਨ ਆ ਉਹ ਬਦਲਤੀ ਗਈ ਹੈ ਮੈਂ ਇਸ ਮੁਸੀਬਤ ਲਈ ਮਾਫੀ ਚਾਹੁੰਦੀ ਹਾਂ ਪਰ ਮੈਂ ਤੁਹਾਡਾ ਕਿਰਾਇਆ ਜੋ ਵੀ ਹੈ ਉਹ ਡਬਲ ਕਰ ਦੂੰਗੀ ਅਤੇ ਤੁਸੀਂ ਪਲੀਜ਼ ਮਾਨਸਾ ਦੀ ਬਜਾਏ ਬਠਿੰਡਾ ਆ ਜਾਓ ਮੈਨੂੰ ਪਿੱਕ ਕਰਨ ਲਈ